ਡੇਂਗੂ ਬੁਖਾਰ ਅਤੇ ਮਲੇਰੀਏ ਤੋਂ ਬਚਣ ਵਾਸਤੇ ਸਾਨੂੰ ਜਿਵੇਂ ਕਿ ਬਰਸਾਤੀ ਪਾਣੀ ਜਿਵੇਂ ਇਕੱਠਾ ਹੋ ਜਾਂਦਾ ਟੋਇਆ ਟਿੱਬਿਆਂ ਦੇ ਵਿੱਚ ਅਤੇ ਪਹਿਲੀ ਤਾਂ ਗੱਲ ਹੈ ਵੀ ਚਲੋ ਘਰਾਂ ਦੇ ਵਿੱਚ ਜੋ ਵੀ ਆਪਣਾ ਪਾਣੀ ਇਕੱਠਾ ਹੁੰਦਾ ਜਿਵੇਂ ਕਿ ਸਾਨੂੰ ਪਤਾ ਕੋਈ ਟਾਇਰ ਪਏ ਆ ਕੁਛ ਟੁੱਟੇ ਟੁੱਟੀਆਂ ਟਾਟੀਆਂ ਟੱਬ ਟੁੱਬ ਵਗੈਰਾ ਜਿਵੇਂ ਆਪਾਂ ਰੱਖ ਦਿੰਦੇ ਹਾਂ ਜਦੋਂ ਬਰਸਾਤ ਹੁੰਦੀ ਉਹਨਾਂ 'ਚ ਪਾਣੀ ਜਮ੍ਹਾਂ ਹੋ ਜਾਂਦਾ ਜਦੋਂ ਸਮੇਂ ਸਿਰ ਆਪਾਂ ਉਹਨਾਂ ਦਾ ਧਿਆਨ ਨਹੀਂ ਕਰਦੇ ਪਾਣੀ ਨਹੀਂ ਕੱਢਦੇ ਉਹਦੇ ਵਿੱਚ ਇਹੋ ਮੱਛਰ ਪਲਣ ਲੱਗ ਜਾਂਦਾ ਕੂਲਰਾਂ ਕਾਲਰਾਂ ਦਾ ਪਾਣੀ ਨਹੀਂ ਸਮੇਂ 'ਤੇ ਬਦਲਦੇ ਵਿੱਚ ਮੱਛਰ ਬਣਨ ਲੱਗ ਪੈਂਦਾ ਤਾਂ ਇਹਦਾ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਵੀ ਸਮੇਂ ਸਮੇਂ ਸਿਰ ਅਤੇ ਚੀਜ਼ਾਂ ਦੀ ਸਫ਼ਾਈ ਹੁੰਦੀ ਰਹੇ ਘਰ ਦੀ ਕਮਰਿਆਂ ਦੀ ਸਫ਼ਾਈ ਹੁੰਦੀ ਰਹੇ ਅਤੇ ਜਿਹੜਾ ਸਮੇਂ ਸਿਰ 'ਤੇ ਇਹਦੀ ਮਤਲਬ ਆਪਣਾ ਜਿਵੇਂ ਕਿ ਡਾਕਟਰ ਟੀਮਾਂ ਆਉਂਦੀਆਂ ਉਹਨਾਂ ਤੋਂ ਦਵਾਈ ਦਵੂਈ ਲਈ ਜਾਵੇ ਅਤੇ ਉਹਨਾਂ ਦੇ ਡਾਕਟਰੀ ਟੀਮ ਡਾਕਟਰਾਂ ਦੀ ਸਲਾਹ ਲਈ ਜਾਵੇ ਅਤੇ ਬਾਕੀ ਜੋ ਵੀ ਆ ਕਿ ਆਪਣਾ ਸਮੇਂ ਦੇ ਸਿਰ 'ਤੇ ਆਪਾਂ ਨੂੰ ਦ ਮੈਡੀਸਨ ਵੀ ਖਾਧੀ ਜਾਵੇ ਇਹਦੀ ਅਤੇ ਬਾਕੀ ਆਪਾਂ ਤਾਂ ਪਹਿਲੀ ਗੱਲ ਹੈ ਕਿ ਆਪਾਂ ਮੱਛਰਾਂ ਤੋਂ ਬਚਾਅ ਹੀ ਕਰਨਾ ਅਤੇ ਸਫ਼ਾਈ ਰੱਖਣੀ ਹੈ ਸਾਰੀ ਅਤੇ ਕਮਰਿਆਂ ਦੇ ਵਿੱਚ ਘਰ ਦੇ ਵਿੱਚ ਨਿੰਮ ਦਾ ਧੂੰਆਂ ਜਿਵੇਂ ਲਾ ਕਰ ਲਈਏ ਹੋਰ ਚੀਜ਼ ਜੋ ਵੀ ਆ ਕੁਛ ਉਹਦਾ ਧੂੰਆ ਕਰਕੇ ਮੱਛਰ ਨੂੰ ਮਾਰ ਭਜਾਉਣ ਦੀ ਕੋਸ਼ਿਸ਼ ਕਰੇ ਕਮਰਿਆਂ ਦੇ ਵਿੱਚ ਆਪਣੀ ਜਿਹੜੇ ਕੋਐਲ ਵਰਤੇ ਜਾਂਦੇ ਆ ਜੋ ਕਿ ਸਿਹਤ ਵਾਸਤੇ ਹਾਨੀਕਾਰਕ ਨਾ ਹੋਣ ਉਹ ਵਰਤੇ ਜਾਣ ਅਤੇ ਇਸੇ ਤਰ੍ਹਾਂ ਆਪਣਾ ਜਿਹੜਾ ਕਿ ਉਹ ਬਚਾਅ ਕੀਤਾ ਜਾਵੇ